ਸਾਡੇ ਇਲਾਕੇ ਵਿੱਚ ਬਹੁਤ ਸਾਰੇ ਪੰਛੀ ਜਿਵੇਂ ਕਾਂ ਘੁੱਗੀਆਂ ਤੋਤੇ ਮੋਰ ਗਰਮੀਆਂ ਦੇ ਵਿੱਚ ਇੱਥੇ ਕੋਇਲਾਂ ਵੀ ਆਉਂਦੀਆਂ ਹਨ ਜਿਹੜੀਆਂ ਕਿ ਸਾਨੂੰ ਆਵਾਜ਼ ਵਾਸਤੇ ਬਹੁਤ ਵਧੀਆ ਲੱਗਦੀਆਂ ਹਨ ਉਹਨਾਂ ਦੇ ਕੋਇਲ ਦੀ ਆਵਾਜ਼ ਬਹੁਤ ਵਧੀਆ ਲੱਗਦੀ ਹੈ ਅਤੇ ਸਭ ਤੋਂ ਜ਼ਿਆਦਾ ਅਸੀਂ ਪਸੰਦ ਮੋਰ ਨੂੰ ਕਰਦੇ ਹਾਂ ਕਿਉਂਕਿ ਜਦੋਂ ਵੀ ਮੋਰ ਖੁਸ਼ ਹੁੰਦਾ ਹੈ ਅਤੇ ਉਹ ਪੈਲ ਪਾਉਂਦਾ ਹੈ ਅਤੇ ਉਹ ਬਹੁਤ ਸੋਹਣਾ ਦ੍ਰਿਸ਼ ਲੱਗਦਾ ਹੈ ਅਤੇ ਉਸ ਟਾਈਮ 'ਤੇ ਉਹਦੇ ਜਿਹੜੇ ਜਿਹੜੇ ਖੰਭ ਹੈ ਉਹ ਬਹੁਤ ਸੋਹਣੇ ਚਮਕਦੇ ਹੈ ਅਤੇ ਬਹੁਤ ਵਧੀਆ ਲੱਗਦਾ ਹੈ ਉਹਨਾਂ ਦੇ ਜਿਹੜੇ ਟੁੱਟੇ ਹੋਏ ਖੰਭ ਹੈ ਅਸੀਂ ਘਰਾਂ ਵਿੱਚ ਵੀ ਲਿਆ ਕੇ ਕਈ ਵਾਰੀ ਰੱਖ ਲੈਂਦੇ ਹਾਂ ਇੱਥੇ ਹੋਰ ਵੀ ਕਾਫੀ ਪੰਛੀ ਜਿਹੜੇ ਬੜੇ ਮਨਮੋਹਕ ਨੈਚੁਰਲੀ ਬੜੇ ਸੋਹਣੇ ਲੱਗਦੇ ਆ